ਵਹਿਮ ਭਰਮ ਅਸੀਂ ਆਪ ਹੀ ਬਣਾਏ ਆ ਇਹੀ ਦੁਨੀਆ ਇਹੀ ਸਾਰਾ ਕੁਛ ਹੈ ਕਹਿੰਦੇ ਜੀ ਊਚ ਨੀਚ ਜਾਤ ਪਾਤ ਇਹ ਉੱਪਰੋ ਲੈ ਕੇ ਨਹੀਂ ਆਏ ਕੋਈ ਜਨਮ ਤੋਂ ਊਚ ਜਿਹੜਾ ਉਹ ਗਰੀਬ ਜਾਂ ਊਚ ਨੀਚ ਜਾਂ ਜੋ ਵੀ ਹੈ ਉਹ ਜਾਤ ਪਾਤ ਦਾ ਕੋਈ ਨਹੀਂ ਹੁੰਦਾ ਅਸੀਂ ਬਣਾਉਂਦੇ ਹੈ ਇਹੀ ਸਾਡੇ ਜਿਹੜੇ ਵਹਿਮ ਭਰਮ ਹੈ ਅਸੀਂ ਕੀਤੇ ਹੈ ਅਸੀਂ ਬਣਾਏ ਹੈ ਅਤੇ ਅਸੀਂ ਹੀ ਇਹਨਾਂ ਨਾਲ ਨਿਪਟਣਾ ਹੈ